ਭੰਗੜਾ ਬਹੁਤ ਵ ਵਧੀਆ ਪੰਜਾਬ ਦਾ ਮਹੱਤਵਪੂਰਨ ਹੈ ਭੰਗੜਾ ਮੁੰਡੇ ਦੀ ਖੁਸ਼ੀ ਵਿੱਚ ਵੀ ਪਾਇਆ ਜਾਂਦਾ ਹੈ ਅਤੇ ਵਿਆਹ ਸ਼ਾਦੀਆਂ ਵਿੱਚ ਵੀ ਪਾਇਆ ਜਾਂਦਾ ਹੈ ਅਤੇ ਭੰਗੜਾ ਪੰਜਾਬ ਕਿਸਾਨਾਂ ਵੱਲੋਂ ਫ਼ਸਲ ਪੱਕਣ ਦੀ ਖੁਸ਼ੀ ਵਿੱਚ ਵੀ ਪਾਇਆ ਜਾਂਦਾ ਹੈ ਵਿਸਾਖੀ 'ਤੇ ਵੀ ਪਾਇਆ ਜਾਂਦਾ ਹੈ ਭੰਗੜਾ ਪੰਜਾਬ ਦਾ ਮਸ਼ਹੂਰ ਨਾਚ ਹੈ ਹਰ ਖੁਸ਼ੀ 'ਤੇ ਮੌਕੇ 'ਤੇ ਭੰਗੜਾ ਪਾਇਆ ਜਾਂਦਾ ਹੈ ਪੰਜਾਬ ਤੋਂ ਬਾਹਰ ਜਿੱਥੇ ਕਿਤੇ ਵੀ ਪੰਜਾਬੀ ਵੱਸਦੇ ਹਨ ਇਹ ਕਦੇ ਵੀ ਨਹੀਂ ਹੋ ਸਕਦਾ ਕਿ ਭੰਗੜਾ ਨਾ ਪਾਇਆ ਜਾਵੇ